ਸਾਡਾ ਪੰਜਾਬੀ ਸੱਭਿਆਚਾਰ ਬਹੁਤ ਹੀ ਅਮੀਰ ਸੱਭਿਆਚਾਰ ਹੈ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਨੱਚ ਭੰਗੜਾ ਗਿੱਧਾ ਬੋਲੀਆਂ ਲੋਕ ਗੀਤ ਗਾਈਆਂ ਟੱਪੇ ਮਾਹੀਆ ਟੱਪੇ ਸਾਡੀ ਪੰਜਾਬੀ ਸੱਭਿਆਚਾਰ ਦੀ ਪਹਿਚਾਣ ਨੇ ਸਬੀ ਪੰਜਾਬੀਆਂ ਸੱਭਿਅਤਾ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਬੋਲੀ ਦੀ ਬਹੁਤ ਜ਼ਿਆਦਾ ਮਹੱਤਵ ਹੈ ਸਾਡੀ ਪੰਜਾਬੀ ਬੋਲੀ ਸਾ ਮਾਝਾ ਮਾਲਵਾ ਦੁਆ ਦੁਆਬਾ ਪੋਠੋਹਾਰੀ ਆਦਿ ਇਲਾਕੇ ਵਿੱਚ ਅਲੱਗ ਅਲੱਗ ਬੋਲੀਆਂ ਜਾਂਦੀਆ ਹੈ ਬਹੁਤ ਹੀ ਮਿੱਠੀ ਅਤੇ ਸੋਹਣੀ ਬੋਲੀ ਹੈ ਅਤੇ ਸਾਡੇ ਪੰਜਾਬੀ ਲੋਕ ਦੁਨੀਆ ਦੇ ਹਰ ਇੱਕ ਹਿੱਸੇ ਵਿੱਚ ਬੋਲੀ ਜਾਂਦੀ ਹੈ ਇਸ ਦਾ ਕਾਰਨ ਇਹ ਹੈ ਕਿ ਪੰਜਾਬ ਪੰਜਾਬੀ ਦੁਨੀਆ ਦੇ ਹਰ ਇੱਕ ਕੋਨੇ ਕੋਨੇ ਵਿੱਚ ਵਸੇ ਹੋਏ ਹਨ ਜਿਸ ਕਰਕੇ ਉਹ ਉੱਥੇ ਪੰਜਾਬੀ ਬੋਲੀ ਬੋਲ ਕੇ ਆਪਣੇ ਪੰਜਾਬੀ ਦੀਆਂ ਪ੍ਰਚਾਰ ਕਰਦੇ ਨੇ ਅਤੇ ਉਹਨਾਂ ਨੂੰ ਪੰਜਾਬੀ ਬੋਲੀ ਬਹੁਤ ਪਸੰਦ ਹੈ ਤਾਂ ਕਿ ਉਹ ਆਪਣੀ ਪੰਜਾਬੀ ਬੋਲੀ ਨਹੀਂ ਛੱਡ ਸਕਦੇ ਅਤੇ ਦੂਸਰੇ ਇਲਾਕਿਆਂ ਵਿੱਚ ਵੀ ਆਪਣੇ ਹੀ ਪੰਜਾਬੀ ਬੋਲ਼ੀਆਂ ਬੋਲੀ ਜਾਂਦੇ ਨੇ ਸਾਡੇ ਪੰਜਾਬੀ ਗੀਤਾਂ ਨੂੰ ਹਰ ਵਰਗ ਦੇ ਲੋਕ ਪਸੰਦ ਕਰਦੇ ਹਨ ਅੱਜ ਕੱਲ੍ਹ ਦੇ ਸਮਾਂ ਵਿੱਚ ਪੰਜਾਬੀ ਗੀਤਾਂ ਨੂੰ ਬੋਲੀਵੁੱਡ ਵਿੱਚ ਵੀ ਸੁਣਨ ਨੂੰ ਮਿਲ ਰਹੇ ਹਨ ਜਿਸ ਕਰਕੇ ਪੰਜਾਬ ਬੋਲੀ ਨੂੰ ਬਹੁਤ ਪਸੰਦ ਕੀਆ ਜਾ ਰਿਹਾ ਹੈ ਅਤੇ ਇਹ ਬਹੁਤ ਸੋਹਣੀ ਬੋਲੀ ਹੈ ਜੋ ਕਿ ਹਰ ਲੋਕ ਬੋਲ ਸਕਦੇ ਨੇ ਅਤੇ ਇਹ ਬਹੁਤ ਮਿੱਠੀ ਹੈ ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਜੇ ਜਨਮ ਤੋਂ ਪੰਜਾਬੀਆਂ ਪੰਜਾਬੀ ਹੀ ਬੋਲਦੇ ਨੇ